ਕੋਈ ਵੀ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਸਨੂੰ ਰਜਿਸਟਰ ਕਰਵਾਉਣਾ ਪੈਂਦਾ ਹੈ ਰਜਿਸਟਰ ਕਰਵਾਉਣ ਤੋਂ ਬਾਅਦ ਸਭ ਤੋਂ ਜਰੂਰੀ ਕੰਮ ਜੀ ਐਸ ਟੀ ਰਜਿਸਟਰੇਸ਼ਨ ਕਰਵਾਣੀ ਪੈਂਦੀ ਹੈ ਅਗਰ ਇਹ ਜੀ ਐਸ ਟੀ ਰਜਿਸਟਰੇਸ਼ਨ ਕੋਈ ਨਹੀਂ ਕਰਵਾਉਂਦਾ ਹੈ ਤੇ ਉਸ ਦੇ ਕਾਰੋਬਾਰ ਵਿੱਚ ਬਹੁਤ ਬਹੁਤ ਜਿਆਦਾ ਨੁਕਸਾਨ ਹੋ ਜਾਂਦਾ ਹੈ ਤੇ ਮੈਂ ਆਪਣਾ ਜੀ ਐਸ ਟੀ ਰਜਿਸਟਰੇਸ਼ਨ ਕਰਵਾਉਣਾ ਚਾਹੁੰਦਾ ਹਾਂ ਤੇ ਮੈਂ ਆਪਣੇ ਜੀ ਐੱਸ ਟੀ ਰਜਿਸਟਰੇਸ਼ਨ ਕਰਵਾਉਣ ਲਈ ਅਤੇ ਅਪਡੇਟ ਕਰਵਾਉਣ ਲਈ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਕਿ ਮੇਰਾ ਇੱਕ ਜੀ ਐਸ ਟੀ ਨੂੰ ਅਪਡੇਟ ਕਰ ਦਿੱਤਾ ਜਾਵੇ ਕਿਉਂਕਿ ਅਗਰ ਇਹ ਅਪਡੇਟ ਨਹੀਂ ਹੋਏਗਾ ਤਾਂ ਮੇਰੇ ਕਾਰੋਬਾਰ ਵਿੱਚ ਬਹੁਤ ਹੀ ਜਿਆਦਾ ਪ੍ਰਭਾਵ ਪਵੇਗਾ ਮੇਰੇ ਕਾਰੋਬਾਰ ਵਿੱਚ ਪ੍ਰਭਾਵ ਪੈਣ ਦੇ ਕਾਰਨ ਮੇਰੀ ਸਲਾਨਾ ਸੇਲ ਘੱਟ ਸਕਦੀ ਹੈ ਤੇ ਮੇਰਾ ਨੁਕਸਾਨ ਹੋ ਸਕਦਾ ਹੈ ਮੈਨੂੰ ਪੈਸਿਆਂ ਦੀ ਤੰਗੀ ਵੀ ਹੋ ਸਕਦੀ ਹੈ ਇਸ ਲਈ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਰਜਿਸ਼ਟ੍ਰੇਸ਼ਨ ਕਰਾਣੀ ਜਰੂਰੀ ਹੈ ਰਜਿਸਟਰੇਸ਼ਨ ਕਰਵਾਉਣ ਤੋਂ ਬਾਅਦ ਹੀ ਸਾਡਾ ਆਪਣਾ ਅੱਗੇ ਕਾਰੋਬਾਰ ਵਧਦਾ ਹੈ ਮੇਰਾ ਨਵਾਂ ਕਾਰੋਬਾਰ ਹੈ ਮੈਨੂੰ ਰਜਿਸਟਰੇਸ਼ਨ ਦੀ ਬਹੁਤ ਲੋੜ ਹੈ ਤੇ ਜਦੋਂ ਤੱਕ ਇਹ ਮੇਰੀ ਬੇਨਤੀ ਹੈ ਕਿ ਮੇਰੀ ਜਲਦੀ ਤੋਂ ਜਲਦੀ ਰਜਿਸਟਰੇਸ਼ਨ ਆਈ ਡੀ ਅਪਡੇਟ ਕਰ ਦਿੱਤੀ ਜਾਵੇ ਤਾਂ ਕਿ ਮੈਂ ਆਪਣਾ ਕਾਰੋਬਾਰ ਕੋਈ ਵਧੀਆ ਤਰੀਕੇ ਨਾਲ ਸ਼ੁਰੂ ਕਰ ਸਕਾਂ ਤੇ ਮੈਂ ਵਧੀਆ ਦੇ ਵਧੀਆ ਪੈਸੇ ਕਮਾ ਸਕਾਂ